ਗਾਉਣ ਲਈ ਮੇਰੇ ਮਨਪਸੰਦੀਦਾ ਗੀਤ ਪੰਜਾਬੀ ਗੀਤ ਹਨ ਕਿਉਂਕਿ ਉਨ੍ਹਾਂ ਨੂੰ ਸੁਣਨਾ ਅਤੇ ਗਾਉਣਾ ਮੇਰੇ ਲਈ ਬਹੁਤ ਹੀ ਆਸਾਨ ਹੈ ਕਿਉਂਕਿ ਇਹ ਮੇਰੀ ਮਾਤਰ ਭਾਸ਼ਾ ਦੇ ਗੀਤ ਹਨ ਮੈਨੂੰ ਬਹੁਤ ਹੀ ਵਧੀਆ ਲੱਗਦਾ ਹੈ ਜਦੋਂ ਪੰਜਾਬੀ ਗੀਤ ਇੰਨੇ ਪਿਆਰੇ ਗੀਤ ਮੈਨੂੰ ਗਾਉਣ ਨੂੰ ਮਿਲਦੇ ਹਨ